ਸੱਤ ਜੂਨ ਉੱਨੀ ਸੌ ਤ੍ਰਿਆਸੀ ਉੱਨੀ ਅਕਤੂਬਰ ਵੀਹ ਸੌ ਬਾਰ੍ਹਾਂ ਉਣੱਤੀ ਮਈ ਉੱਨੀ ਸੌ ਸਤਾਸੀ ਬਾਰ੍ਹਾਂ ਦਸੰਬਰ ਦੋ ਹਜ਼ਾਰ ਨੌਂ ਇਕੱਤੀ ਜੁਲਾਈ ਦੋ ਹਜ਼ਾਰ ਇੱਕੀ